ਸਾਡੀ ਖਿੱਚ ਦੇ ਜਿਹੜੀਆਂ ਮੇਨ ਨਦੀਆਂ ਨੇ ਉਹਨਾਂ ਦੇ ਵਿੱਚ ਆਉਂਦੀਆਂ ਨੇ ਸਤਲੁਜ ਬਿਆਸ ਨਦੀ ਆ ਜੇਹਲਮ ਨਦੀ ਆ ਚੇਨਾਬ ਆ ਇੰਡਸ ਆ ਅਤੇ ਕਾਲੀ ਬੇਈ ਆ ਅਤੇ ਚੱਕੀ ਨਦੀ ਆ ਅਤੇ ਇਹਨਾਂ ਦੇ ਵਿੱਚੋਂ ਪਾਣੀ ਅਕਸਰ ਸੀਜ਼ਨਲ ਵਰਤਿਆ ਜਾਂਦਾ ਜਿਵੇਂ ਕਿਤੇ ਕਿਸਾਨ ਖੇਤਾਂ ਦੇ ਵਿੱਚ ਪਾਣੀ ਲਾਉਂਦੇ ਸੂਏ ਬਣੇ ਪਏ ਨੇ ਅਤੇ ਉਹ ਸੂਹਿਆਂ ਰਾਹੀਂ ਪਾਣੀ ਵਰਤਿਆ ਜਾਂਦਾ ਅਤੇ ਕੁਝ ਲੋਕ ਇਸ ਨੂੰ ਫਿਲਟਰ ਕਰਕੇ ਪਾਣੀ ਨੂੰ ਪੀਣ ਲਈ ਵੀ ਵਰਤਦੇ ਨੇ ਅਤੇ ਜੋ ਪੰਜਾਬ ਦੇ ਵਿੱਚ ਡੈਮ ਨੇ ਉਹ ਨੇ ਜਿਵੇਂ ਸਿਸਵਾ ਡੈਮ ਆ ਮੱਲੀ ਡੈਮ ਨਾ ਡੈਮ ਅਤੇ ਭਾਖੜਾ ਡੈਮ ਆ ਭਾਖੜਾ ਡੈਮ ਅਤੇ ਇਹਨਾਂ ਦੇ ਆਦਿ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਆ ਜੋ ਹੋਰ ਸ਼ਹਿਰਾਂ ਨੂੰ ਭੇਜੀ ਜਾਂਦੀ ਜਿਵੇਂ ਦਿੱਲੀ ਨੂੰ ਬਿਜਲੀ ਜਾਂਦੀ ਆ ਤੇ ਹੋਰ